ਹਾਂ ਕਰਮੀ ਮੈਮ ਹਾਂਜੀ ਮੈਮ ਹਾਂਜੀ ਆਜ ਆਪਾਂ ਪੁੱਛਦੇ ਸੀਗੇ ਬਈ ਤੁਸੀਂ ਬੱਚਿਆਂ ਨਾਲ ਹੁਣ ਕਿਵੇਂ ਹੱਲ ਕੀਤਾ ਜਾਵੇ ਬਈ ਮੀਂਹ ਕਣੀਆਂ ਪੈ ਰਹੀਆਂ ਅਤੇ ਬੱਚਿਆਂ ਦੇ ਮਾਂ ਬਾਪ ਬਈ ਵੈਸੇ ਆਪਾਂ ਨੂੰ ਪੁੱਛ ਰਹੇ ਆ ਨਾ ਅਤੇ ਪੜ੍ਹਾਈ ਦਾ ਕੋਈ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਮੀਂਹ ਵੀ ਬਹੁਤ ਜ਼ਿਆਦਾ ਹੈਗਾ ਇਸ ਕਰ ਹੂੰ ਹੂੰ ਹਾਂਜੀ ਹਾਂਜੀ

ਹਾਂ ਹਾਂਜੀ ਹਾਂਜੀ ਹਾਂਜੀ ਇਹੀ ਕੀਤਾ ਜਾਏ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਇਹ ਆਪਾਂ ਇਹਦਾ ਹੱਲ ਕੱਢੀਏ ਜੀ ਫਿਰ ਉਹਨਾਂ ਦੇ ਮਾਂ ਬਾਪ ਬਈ ਉਹਨਾਂ ਨੂੰ ਆਪਾਂ ਨੂੰ ਪੁੱਛਦੇ ਆ ਕੇ ਅਤੇ ਫਿਰ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਇਹ ਗੱਲਾਂ ਹਾਂਜੀ ਦੇਖੋ ਹਾਂ ਬੱਚਿਆਂ ਨੂੰ ਆਨਲਾਈਨ ਵੀ ਆਪਾਂ ਫੋਨਾਂ 'ਤੇ ਕਰਵਾ ਸਕਦੇ ਹਾਂ ਉਹ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਚਲਦੀ ਰਹੂਗੀ ਅਤੇ ਫਿਰ ਮਾਂ ਬਾਪ ਪਰੇਸ਼ਾਨ ਰਹਿਣਗੇ ਅਤੇ ਨਾਲੇ ਬੱਚੇ ਦਾ ਹੋਮਵਰਕ ਵੀ ਆਪਾਂ ਭੇਜਿਆ ਕਰਾਂਗੇ ਸਕੂਲ ਹਾਂਜੀ ਹਾਂਜੀ ਹਾਂ ਅਤੇ ਉਹ ਮੈਡਮ ਨੂੰ ਪ੍ਰਿੰਸੀਪਲ ਨਾਲ ਗੱਲ ਕਰ ਲੈਂਦੇ ਹਾਂ ਆਪਾਂ

ਹਾਂਜੀ ਹਾਂਜੀ ਹਾਂ ਅਤੇ ਫਿਰ ਹਾਂ ਅਤੇ ਨਹੀਂ ਉਹ ਫਿਰ ਬੱਚਿਆਂ ਦੀ ਮਾਂ ਬਾਪ ਪੁੱਛਦੇ ਫਿਰ ਆਪਾਂ ਉਹਨਾਂ ਨੂੰ ਕੀ ਦੱਸੀਏ ਹੁਣ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਓਕੇ ਹੂੰ